ਮੈਂ ਚਿੱਤਰਕਾਰੀ ਆਪਣੀ ਦੂਜੀ ਕਲਾਸ ਵਿੱਚ ਹੀ ਸ਼ੁਰੂ ਕਰ ਦਿੱਤੀ ਜੋ ਕਿ ਮੇਰਾ ਇੱਕ ਵਿਸ਼ਾ ਸੀ ਸ਼ੁਰੂਆਤ ਵਿੱਚ ਮੈਨੂੰ ਇਸ ਵਿੱਚ ਕੋਈ ਰੁਚੀ ਨਹੀਂ ਸੀ ਜਦੋਂ ਸਾਡੀ ਅਧਿਆਪਿਕਾ ਨੇ ਸਾਨੂੰ ਵੱਖ ਵੱਖ ਤਰ੍ਹਾਂ ਦੇ ਰੰਗ ਵਰਤਣੇ ਸਿਖਾਏ ਤਾਂ ਮੇਰਾ ਵੀ ਚਿੱਤਰ ਬਣਾਉਣ ਦਾ ਦਿਲ ਕੀਤਾ ਇਸ ਤੋਂ ਇਲਾਵਾ ਮੈਨੂੰ ਤਸਵੀਰਾਂ ਬਣਾਉਣੀਆਂ ਵੀ ਸਿਖਾਈਆਂ ਗਈਆਂ ਮੇਰੇ ਇੱਕ ਕਿੱਤਾ ਬਣ ਗਿਆ ਮੈਂ ਡਰੈਂਗ ਵਿੱਚ ਬਹੁਤ ਵਧੀਆ ਡਰੈਂਗ ਬਣਾਉਣ ਲੱਗਿਆ ਮੇਰਾ ਮਨਪਸੰਦ ਕਲਾਕਾਰ ਪਾਰਲੋ ਹੈ ਜੋ ਕਿ ਬਹੁਤ ਹੀ ਵਧੀਆ ਚਿੱਤਰ ਬਣਾਉਂਦਾ ਹੈ